ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਰਿਵਾਇਤਾਂ ਸਮੱਗਰੀ ਅਤੇ ਤਕਨੀਕਾਂ ਦੀ ਵਰਤੋਂ ਅਸੀਂ ਪੱਥਰਾਂ ਤੋਂ ਕਰ ਸਕਦੇ ਹਨ ਜਿਵੇਂ ਕਿ ਕੁਦਰਤੀ ਰੰਗਾਂ ਹੱਥ ਕੱਤੇ ਫੈਬਰਿਕ ਅਤੇ ਹੱਥਾਂ ਨਾਲ ਅਸੀਂ ਉਹਨਾਂ ਲੱਕੜ ਨੂੰ ਉਕਾਰੀ ਦੇ ਸਕਦੇ ਹਾਂ